ਮੈਨੂੰ ਬੈਡਮਿੰਟਨ ਖੇਡਣਾ ਪਸੰਦ ਹੈ ਮੈਂ ਕਈ ਸਾਲਾਂ ਤੋਂ ਬੈਡਮਿੰਟਨ ਖੇਡਦਾ ਆ ਰਿਹਾ ਹਾਂ ਹੁਣ ਮੈਨੂੰ ਦਸ ਸਾਲ ਹੋ ਚੁੱਕੇ ਹਨ ਸਾਡੇ ਘਰ ਕੋਲ ਇੱਕ ਛੋਟਾ ਜਿਹਾ ਪਾਰਕ ਵੀ ਹੈ ਉਸ ਪਾਰਕ ਵਿੱਚ ਮੈਂ ਅਤੇ ਮੇਰਾ ਦੋਸਤ ਹਰਸ਼ ਅਸੀਂ ਦੋਵੇਂ ਬੈਡਮਿੰਟਨ ਖੇਡਦੇ ਹਾਂ ਸਾਨੂੰ ਦੋਵਾਂ ਨੂੰ ਬੈਡਮਿੰਟਨ ਖੇਡਣਾ ਬਹੁਤ ਵਧੀਆ ਲੱਗਦਾ ਹੈ ਸ਼ਾਮ ਛੇ ਵਜੇ ਅਸੀਂ ਦੋਵੇਂ ਸਾਡੇ ਘਰ ਕੋਲ ਇੱਕ ਪਾਰਕ ਵਿੱਚ ਖੇਡਣ ਜਾਂਦੇ ਹਾਂ ਮੈਂ ਸਕੂਲ ਪੱਧਰ 'ਤੇ ਵੀ ਸਟੇਟ ਲੈਵਲ ਉੱਤੇ ਬੈਡਮਿੰਟਨ ਖੇਡ ਕੇ ਆਇਆ ਹਾਂ ਉੱਥੇ ਮੈਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਬੈਡਮਿੰਟਨ ਖੇਡਣ ਨਾਲ ਮਨ ਦੀ ਤੰਦਰੁਸਤੀ ਹੁੰਦੀ ਹੈ ਅਤੇ ਸਰੀਰ ਦਾ ਵੀ ਵਿਕਾਸ ਹੁੰਦਾ ਹੈ ਬੈਡਮਿੰਟਨ ਖੇਡਣ ਨਾਲ ਮਨ ਦੀ ਤ੍ਰਿਪਤੀ ਹੋ ਜਾਂਦੀ ਹੈ ਅਤੇ ਕਈ ਚੰਗੀਆਂ ਗੱਲਾਂ ਵੀ ਅਸੀਂ ਇਸ ਰਾਹੀਂ ਸਿੱਖਦੇ ਹਾਂ